ਸਾਡੇ ਖੇਤਰ ਵਿੱਚ ਆਮ ਤੌਰ 'ਤੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਜੋ ਕਿ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਸਥਿਤ ਪਿੰਡ ਹੈ ਜਿੱਥੇ ਕਿ ਮਲਵਈ ਭਾਸ਼ਾ ਹੀ ਬੋਲੀ ਜਾਂਦੀ ਹੈ ਜ਼ਿਆਦਾਤਰ ਪੰਜਾਬ ਵਿੱਚ ਮਾਝੀ ਦੁਆਬੀ ਅਤੇ ਪੋਠੋਹਾਰੀ ਭਾਸ਼ਾ ਹੀ ਬੋਲੀ ਜਾਂਦੀ ਹੈ ਅਸੀਂ ਜਿਸ ਇਲਾਕੇ ਵਿੱਚ ਰਹਿ ਰਹੇ ਹਾਂ ਉਸ ਵਿੱਚ ਮਾਲਵੇ ਦੀ ਮਲਵਈ ਭਾਸ਼ਾ ਹੀ ਵਰਤੀ ਜਾਂਦੀ ਹੈ ਇਹ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਕਿਉਂਕਿ ਜਨਮ ਤੋਂ ਹੀ ਅਸੀਂ ਜਦੋਂ ਮਾਤਾ ਤੋਂ ਪੈਦਾ ਹੋਏ ਹਾਂ ਤਾਂ ਗਰਭ ਤੋਂ ਬਾਅਦ ਸਾਡੀ ਜਿਹੜੀ ਬੋਲੀ ਹੈ ਉਹ ਮਲਵਈ ਮਾਲਵੇ ਦੀ ਪੰਜਾਬੀ ਹੀ ਹੈ ਜਿਸ ਵਿੱਚ ਸਾਨੂੰ ਸਕੂਲ ਵਿੱਚ ਪੜ੍ਹਾਈ ਦੇ ਤੌਰ 'ਤੇ ਪਹਿਲ ਦੇ ਆਧਾਰ 'ਤੇ ਪੰਜਾਬੀ ਵਿਸ਼ੇ ਨੂੰ ਹੀ ਚੁਣਵੇਂ ਵਿਸ਼ੇ ਵਜੋਂ ਰੱਖਦੇ ਹਾਂ ਇਸ ਦੇ ਨਾਲ ਨਾਲ ਅਸੀਂ ਆਪਣੇ ਜੋ ਬੋਲਚਾਲ ਦੀ ਭਾਸ਼ਾ ਹੈ ਉਹ ਅਸੀਂ ਪੰਜਾਬੀ ਹੀ ਵਰਤਦੇ ਹਾਂ ਇਸ ਦੇ ਵਿੱਚ ਕਲ ਸਾਡੇ ਕਈ ਪੰਜਾਬ ਵਿੱਚ ਰਹਿ ਕੇ ਹੋਰ ਭਾਸ਼ਾ ਦਾ ਪ੍ਰਯੋਗ ਨਹੀਂ ਕਰਦੇ ਅਸੀਂ ਪੰਜਾਬੀ ਹੀ ਬੋਲਦੇ ਹਾਂ ਪੰਜਾਬੀ ਬੋਲਣ ਵਿੱਚ ਹੀ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿਉਂਕਿ ਇਸ ਦੇ ਨਾਲ ਨਾਲ ਅਸੀਂ ਜੋ ਪੰਜਾਬ ਦੇ ਵੱਖ ਵੱਖ ਸਰਕਾਰੀ ਅਦਾਰੇ ਹਨ ਜਿਵੇਂ ਕਿ ਨਗਰ ਪੰਚਾਇਤ ਸਕੂਲ ਦਫਤਰ ਅਤੇ ਹੋਰ ਯੋਗ ਦਫਤਰਾਂ ਵਿੱਚ ਵੀ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਇਸ ਦੇ ਨਾਲ ਨਾਲ ਪੰਜਾਬ ਦੇ ਵਸਨੀਕ ਹੋਣ ਕਰਕੇ ਸਾਨੂੰ ਪੰਜਾਬੀ ਭਾਸ਼ਾ ਬੋਲਣ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਪੰਜਾਬੀ ਭਾਸ਼ਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਿਖਾਉਣੀ ਚਾਹੀਦੀ ਹੈ ਕਿਉਂਕਿ ਇਹ ਆਪਣੀ ਮਾਤ ਭਾਸ਼ਾ ਹੋਣ ਕਰਕੇ ਸਾਨੂੰ ਆਪਣੇ ਅਦਾਰਿਆਂ ਵਿੱਚ ਅਤੇ ਹੋਰ ਜ਼ਿਆਦਾਤਰ ਕੰਮ ਪੰਜਾਬੀ ਵਿੱਚ ਹੀ ਹੁੰਦੇ ਹਨ ਜੋ ਕਿ ਕੋਈ ਵੀ ਸਰਕਾਰੀ ਪੱਤਰ ਆਦਿ ਪੜ੍ਹਨ ਅਖਬਾਰ ਪੜ੍ਹਨਾ ਅਤੇ ਹੋਰ ਪੱਤਰ ਆਦਿ ਪੜ੍ਹਨ ਵਿੱਚ ਬਹੁਤ ਮਦਦ ਕਰਦੇ ਹਨ ਇਹ ਸਾਡੇ ਜੀਵਨ ਦੀ ਭਾਸ਼ਾ ਹੈ ਇਸ ਕਰਕੇ ਸਾਨੂੰ ਪੰਜਾਬੀ ਭਾਸ਼ਾ ਬਹੁਤ ਹੀ ਜ਼ਰੂਰੀ ਹੈ ਪੰਜਾਬ ਵਿੱਚ ਰਹਿੰਦੇ ਹੋਏ ਸਾਨੂੰ ਆਪਣੀ ਮਾਤ ਭਾਸ਼ਾ ਨਾਲ ਬਹੁਤ ਪਿਆਰ ਹੈ ਜਿਸ ਨਾਲ ਅਸੀਂ ਆਪਣੀ ਪੰਜਾਬੀ ਭਾਸ਼ਾ ਬੋਲਣ 'ਤੇ ਬਹੁਤ ਉੱਚੇ ਅਹੁਦਿਆਂ 'ਤੇ ਵੀ ਵਿਕਾਸ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਅਸੀਂ ਆਪਣੀ ਭਾਸ਼ਾ ਦੇ ਹੋਰ ਨਿੱਜੀ ਜੀਵਨ ਵਿੱਚ ਵੀ ਤਰੱਕੀ ਕਰ ਸਕਦੇ ਹਾਂ ਸਾਨੂੰ ਆਪਣੀ ਮਾਂ ਬੋਲੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ ਧੰਨਵਾਦ ਸਾਹਿਬ ਜੀ